ਜਿਹੜੇ ਪੰਜਾਬ ਦੀ ਧਰਤੀ ਹੈ ਉੱਥੋਂ ਦੇ ਵਸਨੀਕ ਨੇ ਜਿਹੜੇ ਉਹਨਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ ਅਤੇ ਵੱਡੀ ਜਨਸੰਖਿਆ ਵੱਡੀ ਤਾਦਾਦ ਦੇ ਵਿੱਚ ਜਿਹੜੇ ਉੱਥੋਂ ਦੇ ਲੋਕ ਨੇ ਖੇਤੀਬਾੜੀ ਦੇ ਉੱਤੇ ਨਿਰਭਰ ਕਰਦੇ ਨੇ ਤਾਂ ਜੇ ਦੇਖਿਆ ਜਾਵੇ ਕਿਸੇ ਕਿਸਾਨ ਪਰਿਵਾਰ ਦੇ ਵਿੱਚ ਤਾਂ ਜਿਹੜਾ ਉਹਦਾ ਮੁੱਖ ਧੰਦਾ ਖੇਤੀਬਾੜੀ ਹੀ ਹੈ ਜੇਕਰ ਉਸ ਦੀ ਫਸਲ ਚੰਗੀ ਹੁੰਦੀ ਹੈ ਤਾਂ ਉਸ ਦਾ ਜਿਹੜਾ ਤੋਰੀਆ ਘਰ ਦਾ ਤੁਰਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਜਿਹੜੇ ਕਿਸਾਨਾਂ ਦਾ ਜਿਹੜਾ ਪੱਧਰ ਆ ਉਹ ਦਿਨੋਂ ਦਿਨ ਨੀਵਾਂ ਹੁੰਦਾ ਜਾ ਰਿਹਾ ਡਾਊਨ ਹੁੰਦਾ ਜਾ ਰਿਹਾ ਇਸ ਦਾ ਮੁੱਖ ਕਾਰਨ ਇਹੀ ਹੈ ਵੀ ਜਦੋਂ ਜਾਂ ਤਾਂ ਬਦਲਦੇ ਮੌਸਮਾਂ ਦੇ ਕਾਰਨ ਜਿਹੜੀਆਂ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਨੇ ਜਾਂ ਫਿਰ ਘਟੀਆਂ ਰੇਹਾਂ ਸਪਰੇਹਾਂ ਦੇ ਕਾਰਨ ਫਸਲਾਂ ਮਰ ਜਾਂਦੀਆਂ ਨੇ ਜਾਂ ਅਸੀਂ ਕਹਿ ਸਕਦੇ ਹਾਂ ਕਿ ਵੀ ਵਧੀਆ ਬੀਜ ਨਾ ਹੋਣ ਕਰਕੇ ਜਾਂ ਪਾਣੀ ਦੀ ਮਾਤਰਾ ਜਿੰਨੀ ਫਸਲ ਨੂੰ ਚਾਹੀਦੀ ਹੈ ਓਨੀ ਨਾ ਮਿਲਣ ਕਰਕੇ ਜਿਹੜੇ ਕੀ ਆ ਨੇ ਉਹਨਾਂ ਦੀਆਂ ਫਸਲਾਂ ਬਰਬਾਦ ਹੁੰਦੀਆਂ ਨੇ ਤਾਂ ਜਦੋਂ ਕਿਸਾਨ ਆ ਜਿਹੜੇ ਉਹ ਕਰਜ਼ੇ ਦੇ ਥੱਲੇ ਦੱਬ ਜਾਂਦੇ ਨੇ ਤਾਂ ਉਹਨਾਂ ਦੇ ਜਿਹੜੇ ਖਰਚੇ ਨੇ ਉਹ ਪੂਰੇ ਨਹੀਂ ਹੋ ਪਾਉਂਦੇ ਤਾਂ ਉਹ ਕਰਜ਼ੇ ਦੇ ਵਿੱਚ ਹੇਠ ਆਉਣ ਕਰਕੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਤਾਂ ਉਹਨਾਂ ਨੂੰ ਅੱਕਿਆਂ ਨੂੰ ਕੀ ਇੱਕ ਜਿਹੜਾ ਖੁਦਕੁਸ਼ੀ ਦਾ ਜਿਹੜਾ ਕਦਮ ਆ ਚੁੱਕਣਾ ਪੈਂਦਾ ਹੈ ਤਾਂ ਉਸ ਦੁਨੀਆ ਤੋਂ ਫਿਰ ਜਾਣਾ ਹੀ ਜ਼ਿਆਦਾ ਮਤਲਬ ਕਿ ਪਸੰਦ ਕਰਨਗੇ ਕਰਦੇ ਨੇ ਜਦੋਂ ਅਜਿਹਾ ਕੋਈ ਘਾਟਾ ਉਹਨਾਂ ਨੂੰ ਪੈਂਦਾ ਹੈ ਤਾਂ ਸਾਨੂੰ ਇਸ ਤੋਂ ਕਿਵੇਂ ਬਚਣਾ ਚਾਹੀਦਾ ਹੈ ਅਸੀਂ ਇਸ ਤਰੀਕੇ ਨਾਲ ਹੀ ਬਚ ਸਕਦੇ ਹਾਂ ਵੀ ਜੋ ਪੰਜਾਬ ਦੀ ਧਰਤੀ ਦੇ ਲੋਕ ਨੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਨਿਰਾ ਸਿਰਫ ਕਿਸਾਨੀ ਦੇ ਉੱਤੇ ਜਾਂ ਫ ਖੇਤੀਬਾੜੀ ਦੇ ਉੱਤੇ ਹੀ ਨਿਰਾ ਪੂਰਾ ਨਿਰਭਰ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਆਪਣੇ ਕੁਝ ਹੋਰ ਧੰਦੇ ਸ਼ੁਰੂ ਕਰਨੇ ਚਾਹੀਦੇ ਹਨ ਜੇਕਰ ਸਾਡੀਆਂ ਫਸਲਾਂ ਮਰ ਜਾਂਦੀਆਂ ਨੇ ਤਾਂ ਸਾਨੂੰ ਜਿਹੜਾ ਉਹ ਦੂਜੇ ਧੰਦੇ ਤੋਂ ਸਾਡਾ ਜਿਹੜਾ ਆਰਥਿਕ ਲੈਵਲ ਚਲਦਾ ਰਹੇ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਤਾਂ ਕਿ ਉਹ ਜਗ੍ਹਾ ਜਗ੍ਹਾ ਦੇ ਉੱਤੇ ਖੇਤੀਬਾੜੀ ਨਾਲ ਸੰਬੰਧਿਤ ਕੈਂਪ ਲਗਵਾ ਕੇ ਕਿਸਾਨਾਂ ਨੂੰ ਜਾਗਰੂਕ ਕਰਦੇ ਰਹਿਣ ਔਰ ਜਿਹੜੀਆਂ ਘਟੀਆਂ ਰੇਹਾਂ ਸਪਰੇਹਾਂ ਮਿਲਾਵਟੀ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਉਹਨਾਂ ਨੂੰ ਠੱਲ੍ਹ ਪਾ ਕੇ ਜਿਹੜਾ ਰੋਕ ਸਕਣ